ਸਾਡੇ ਇਲਾਕੇ ਵਿੱਚ ਬਹੁਤ ਜ਼ਿਆਦਾ ਸਿਆਸੀ ਪਾਰਟੀਆਂ ਹੈਗੀਆਂ ਵਾ ਜਿਵੇਂ ਕਿ ਅਕਾਲੀ ਦਲ ਭਾਜਪਾ ਹੋਰ ਵੀ ਕਈ ਤਰ੍ਹਾਂ ਦੀਆਂ ਪਾਰਟੀਆਂ ਹਨ ਅਤੇ ਅੱਜ ਕੱਲ੍ਹ ਤਾਂ ਆਮ ਪਾਰਟੀ ਆ ਰਹੀ ਆ ਆਮ ਪਾਰਟੀ ਬਹੁਤ ਜ਼ਿਆਦਾ ਸਹੂਲਤਾਂ ਦੇ ਰਹੀ ਹੈ ਕਈ ਬੱਚਿਆਂ ਦੀਆਂ ਫੀਸਾਂ ਮਾਫ ਕਰ ਰਹੀ ਹੈ ਕਈ ਜਗ੍ਹਾ 'ਤੇ ਉਹਨਾਂ ਨੂੰ ਨੌਕਰੀਆਂ ਦੇ ਰਹੀ ਹੈ ਆਮ ਪਾਰਟੀ ਵਧੀਆ ਹੈ ਬਿਜਲੀ ਵੀ ਫਰੀ ਕਰ ਰਹੀ ਹੈ ਕਈ ਥਾਵਾਂ 'ਤੇ ਜਿਵੇਂ ਡੈਮ ਵਗੈਰਾ ਵੀ ਲਗਵਾ ਰਹੀ ਹੈ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖ ਰਹੀ ਹੈ ਸਿਆਸੀ ਪਾਰਟੀਆਂ ਵਿੱਚੋਂ ਕਈ ਪਾਰਟੀਆਂ ਅਜਿਹੀਆਂ ਵੀ ਹਨ ਜੋ ਸਾਡਾ ਨੁਕਸਾਨ ਵੀ ਕਰਦੀਆਂ ਹਨ ਪਰ ਕਈ ਪਾਰਟੀਆਂ ਬਹੁਤ ਵਧੀਆਂ ਹਨ ਜੋ ਸਾਨੂੰ ਵਧੀਆ ਪ੍ਰਫੁਲਿਤ ਕਰਦੀਆਂ ਹਨ ਪਾਰਟੀ ਆਪਾਂ ਖੁਦ ਲੋਕ ਹੀ ਬਣਾਉਂਦੇ ਹਾਂ ਪਰ ਵੇਖ ਕੇ ਬਣਾਉਂਦੇ ਹਾਂ ਕਿ ਇਹ ਪਾਰਟੀ ਸਾਡੇ ਲਈ ਵਧੀਆ ਹੈ ਇਹ ਸਾਨੂੰ ਸੁੱਖ ਦੇਵੇਗੀ ਸੁੱਖ ਦੇ ਸਮਾਧਾਨ ਦੇਵੇਗੀ ਸਾਡੇ ਨੇ ਵਧੀਆ ਹੈਗੀ ਸਾਨੂੰ ਨੌਕਰੀਆਂ ਦੇਵੇਗੀ ਸਾਨੂੰ ਸਕੋਲਰਸ਼ਿਪਸ ਪੈਨਸ਼ਨਾਂ ਵਗੈਰਾ ਦੇਵੇਗੀ ਪਰ ਜੋ ਅੱਜ ਕੱਲ੍ਹ ਸਾਡੀ ਆਮ ਪਾਰਟੀ ਆਈ ਹੈ ਦੋ ਹਜ਼ਾਰ ਇੱਕੀ ਬਾਈ 'ਚ ਜੋ ਸਾਡੀ ਆਮ ਪਾਰਟੀ ਆਈ ਹੈ ਆਮ ਪਾਰਟੀ ਵਧੀਆ ਇਹਨਾਂ ਨੇ ਸਾਡੇ ਬਿਜਲੀ ਦੇ ਖਰਚੇ ਵੀ ਘਟਾਏ ਹਨ ਸਰਕਾਰੀ ਨੌਕਰੀਆਂ ਵੀ ਕਈ ਬੱਚਿਆਂ ਨੂੰ ਦਿੱਤੀਆਂ ਹਨ ਹੋਰ ਵੀ ਗਰੀਬ ਬੱਚਿਆਂ ਦੇ ਘਰ ਵੀ ਕਈਆਂ ਦੇ ਬਣਾਏ ਹਨ ਗਰੀਬ ਬੱਚਿਆਂ ਦੀਆਂ ਫੀਸਾਂ ਵੀ ਮਾਫ ਕੀਤੀਆਂ ਹਨ ਬਸ ਪਾਰਟੀਆਂ ਵਧੀਆ ਹੁੰਦੀਆਂ ਵਾ ਜੇ ਆਪਾਂ ਇਹਨਾਂ ਨੂੰ ਵਧੀਆ ਬਣਾ ਸਕੀਏ